ਦੋ ਹਜ਼ਾਰ ਦੋ ਹਜ਼ਾਰ ਨੌਂ ਸੌ ਸਤਾਨਵੇਂ ਪੱਚੀ ਸੌ ਸਤਾਨਵੇਂ ਤਿੰਨ ਹਜ਼ਾਰ ਪੰਜ ਸੌ ਛਿਆਹਠ ਦੋ ਹਜ਼ਾਰ ਨੌਂ ਸੌ ਇਕਾਨਵੇਂ